ਮੇਰੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹ ਸਰਕਾਰ ਜਿਹੜੀ ਹ ਉਹ ਦੇਸ਼ ਵਿਦੇਸ਼ ਦੇਸ਼ ਦੀ ਭੂਮਿਕਾ ਬੜੀ ਅੱਛੀ ਤਰ੍ਹਾਂ ਨਿਭਾਅ ਰਹੀ ਹੈ ਉਹ ਆਪਣੇ ਤਰੀਕੇ ਨਾਲ ਸਾਰਾ ਕੰਮ ਸਹੀ ਕਰ ਰਹੀ ਹੈ ਜਿਹੜੇ ਕਿ ਅੰਤਰਰਾਸ਼ਟਰੀ ਜਿਹੜੀ ਉਹਨਾਂ ਦੀ ਸਬੰਧਤ ਹੈਗੀਆਂ ਨੇ ਉਹਨਾਂ ਦੀ ਭੂਮਿਕਾ ਵੀ ਬੜੀ ਅੱਛੀ ਤਰ੍ਹਾਂ ਨਿਭਾ ਰਹੀ ਹੈ ਉਹ ਕਹਿੰਦੀ ਆ ਸਾਡਾ ਸਾਡਾ ਜਿਹੜਾ ਲੇਨ ਦੇਣ ਹ ਸਾਡਾ ਬਿਜਨਸ ਹੈ ਸਾਡਾ ਵਪਾਰ ਹੈ ਇਹਨਾਂ ਨਾਲ ਚਲਦਾ ਰਵੇ ਉਹ ਬਹੁਤ ਅੱਛੀ ਤਰਾਂ ਉਹ ਆਪਣਾ ਕੰਮ ਕਰ ਰਹੀ ਹੈ ਉਹ ਕਹਿੰਦੀ ਸਾਡਾ ਭਾਈਚਾਰਾ ਬਣਿਆ ਰਵੇ ਇਹਨਾਂ ਨਾਲ ਤੇ ਉਹ ਉਸਨੂੰ ਹਰ ਵੇਲੇ ਆਪਾਂ ਇਹਨਾਂ ਨੂੰ ਉਹਨਾਂ ਦੇ ਨਾਲ ਨਾਲ ਮਿਲਦੀ ਗਿਲਦੀ ਰਹਿੰਦੀ ਹੈ ਆਪਸੀ ਇਹਨਾਂ ਦੇ ਸੰਬੰਧ ਬਣੇ ਰਹਿੰਦੇ ਨੇ ਸੰਬੰਧ ਬਣਨ ਨਾਲ ਇਹਨਾਂ ਦਾ ਜਿਆਦਾ ਕੀ ਭਾਈਚਾਰਾ ਵਧੀਆ ਰਹਿੰਦਾ ਹੈ ਜਿਹੜਾ ਕਿ ਇਹਨਾਂ ਨੂੰ ਹਰ ਵੇਲੇ ਲੋੜ ਪੈਂਦਾ ਰਹਿੰਦਾ ਹੈ ਤੇ ਭਾਈਚਾਰਾ ਵਧਣ ਨਾਲ ਸਾਡਾ ਕੰਮ ਵੀ ਵਧੇਗਾ ਸਾਡਾ ਵਪਾਰ ਵੀ ਵਧੇਗਾ ਤੇ ਸਾਡੀ ਦੇਸ਼ ਦੀ ਖੁਸ਼ਹਾਲੀ ਸਾਡੇ ਪੰਜਾਬ ਦੀ ਖੁਸ਼ਹਾਲੀ ਵੀ ਹੋਏਗੀ ਸਾਡੇ ਸਾਰੇ ਦੇਸ਼ ਦੀ ਖੁਸ਼ਹਾਲੀ ਹੋਏਗੀ ਬੜੀ ਤੇ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਹੋਏਗਾ ਤੇ ਲੋਕੀ ਬੜੇ ਬੜੇ ਵੱਡੇ ਕੰਮ ਕਰ ਸਕਣਗੇ ਤੇ ਲੋਕੀ ਆਪਣਾ ਆਪਣਾ ਜਿਹੜਾ ਬਿਜਨਸ ਹੈ ਉਹ ਵੀ ਚਲਾ ਸਕਣ ਕਿ ਬੜਾ ਕੰਮ ਚਲਾ ਸਕਣਗੇ ਤੇ ਲੋਕੀ ਬੜੇ ਖੁਸ਼ ਆ ਸੰਸ ਸਰਕਾਰ ਤੋਂ ਬੜੇ ਕਹਿੰਦੇ ਨੇ ਕਿ ਠੀਕ ਹੈ ਇਹ ਬੜੀ ਅੱਛੀ ਤਰਾਂ ਕੰਮ ਕਰ ਰਹੀ ਹੈ ਅੰਤਰਰਾਸ਼ਟਰੀ ਰਲ ਕੇ ਇਹ ਮਸਲੇ ਬਾਹਰ ਜਾਣ ਦੇ ਲੋਕਾਂ ਦੇ ਮਸਲੇ ਕਰ ਰਹੀ ਹੈ ਹੱਲ ਬੜੇ ਬੜੇ ਤਰ੍ਹਾਂ ਦੇ ਇਹਨਾਂ ਦੇ ਬਹੁਤ ਤਰ੍ਹਾਂ ਦੇ ਮਸਲੇ ਜਿਹੜੇ ਸੀਗੇ ਉਹਨਾਂ ਦੇ ਘਰਦੀ ਫਿਰਦੀ ਹੈ ਸਰਕਾਰ ਤੇ ਜਿਹੜੀ ਸਰਕਾਰ ਹੈ ਇਹ ਸਰਕਾਰ ਬਹੁਤ ਅੱਛੀ ਤਰ੍ਹਾਂ ਲੋਕਾਂ ਨੂੰ ਗਾਈਡ ਕਰ ਰਹੀ ਏ ਕਿ ਕਰੋ ਤੇ ਇਹ ਸਾਰੇ ਕੰਮ ਇਹ ਕਰ ਧੰਨਵਾਦ ਜੀ